ਜੇ ਅਸੀਂ ਆਪਣੇ ਸਮਾਜ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਜਿਹੜੀਆਂ ਔਰਤਾਂ ਨੇ ਉਹਨਾਂ ਦਾ ਕੋਈ ਵੀ ਇੰਨਾ ਖਾਸ ਸਮਰਥਨ ਨਹੀਂ ਕਰਦਾ ਕਿ ਜੇ ਉਹ ਡਾਂਸਿੰਗ ਨੂੰ ਐਜ ਆਪਣਾ ਜਿਹੜਾ ਹੈਗਾ ਵੈ ਪੈਸ਼ਨ ਚੂਜ ਕਰਦੀਆਂ ਨੇ ਕਰੀਅਰ ਚੂਜ ਕਰਦੀਆਂ ਨੇ ਕਿਉਂਕਿ ਅੱਜ ਕੱਲ੍ਹ ਦੇ ਜਿਹੜਾ ਸਮਾਜ ਹੈਗਾ ਨਾ ਉਹਨਾਂ ਲੋਕਾਂ ਦੀ ਸੋਚ ਕਾਫੀ ਮਤਲਬ ਡਿਫਰੈਂਟ ਹੋ ਚੁੱਕੀ ਆ ਉਹ ਨਹੀਂ ਉਸ ਚੀਜ਼ ਨੂੰ ਜਿਹੜਾ ਉਹ ਚੰਗਾ ਸਮਝਦੇ ਉਹਨਾਂ ਨੂੰ ਸਭ ਤੋਂ ਪਹਿਲਾਂ ਤਾਂ ਇਹ ਪ੍ਰੋਬਲਮਸ ਆਉਂਦੀਆਂ ਨੇ ਕਿ ਜਿਵੇਂ ਜਿਹੜੀ ਸੁਸਾਇਟੀ ਆ ਈਵਨ ਉਹਨਾਂ ਦੀ ਆਪਣੀ ਫੈਮਲੀ ਉਹਨਾਂ ਨੂੰ ਸਪੋਰਟ ਨਹੀਂ ਕਰਦੀ ਜੇ ਕਿਤੇ ਉਹ ਕਰਦੀ ਹੈ ਤਾਂ ਜਿਹੜੀ ਸੋਸਾਇਟੀ ਹੈਗੀ ਹੈ ਉਹ ਉਹਨਾਂ ਨੂੰ ਕਾਫੀ ਮਤਲਬ ਬੁਰੀ ਨਜ਼ਰ ਨਾਲ ਹੀਣ ਭਾਵਨਾ ਨਾਲ ਵੇਖਦੀ ਹੈ ਕਿ ਅੱਛਾ ਇਹਨੇ ਡਾਂਸਿੰਗ ਨੂੰ ਆਪਣਾ ਜਿਹੜਾ ਕਰੀਅਰ ਹੈਗਾ ਉਹ ਚੂਜ ਕੀਤਾ ਵੈ ਫਿਰ ਉਹਨਾਂ ਨੂੰ ਆਪਣੇ ਆਪ ਨੂੰ ਫਿਟ ਰੱਖਣਾ ਪੈਂਦਾ ਜੇ ਆਪਾਂ ਦੇਖੀਏ ਕਿ ਇੱਕ ਡਾਂਸਰ ਜਿਹੜੀ ਹੈ ਉਹ ਦੂਸਰੇ ਨੋਰਮਲ ਹਿਊਮਨ ਬੀਂਗ ਦੇ ਨਾਲੋਂ ਜਿਹੜੀ ਉਹ ਪ ਜ਼ਿਆਦਾ ਫਿੱਟ ਹੋਣੀ ਚਾਹੀਦੀ ਆ ਕਿਉਂਕਿ ਉਹਦੀ ਡਾਂਸ ਮੂਮੈਂਟਸ ਉਸ ਤਰ੍ਹਾਂ ਹੁੰਦੀਆਂ ਅਤੇ ਉਹਨਾਂ ਨੂੰ ਫਿਟਨੈਸ ਦੇ ਉੱਤੇ ਕਾਫੀ ਜ਼ਿਆਦਾ ਜਿਹੜਾ ਉਹ ਧਿਆਨ ਰੱਖਣਾ ਪੈਂਦਾ ਜਿਹੜੇ ਜੇ ਉਹਦੇ ਵਿੱਚ ਵੀ ਕਾਫੀ ਪ੍ਰੋਬਲਮਸ ਉਹਨਾਂ ਨੂੰ ਆ ਜਾਂਦੀਆਂ ਹੈ ਨਾ ਅਤੇ ਕਈ ਵਾਰੀ ਕੀ ਹੁੰਦਾ ਡਾਂਸਿੰਗ ਕਰਦੇ ਕਰਦੇ ਉਹਨਾਂ ਦੇ ਕਦੀ ਫੁੱਟ 'ਤੇ ਇੰਜਰੀ ਹੋ ਜਾਂਦੀ ਹੈ ਕਦੀ ਨੀਂ 'ਤੇ ਇੰਜਰੀ ਹੋ ਜਾਂਦੀ ਹੈ ਕਦੀ ਐਂਕਲ 'ਤੇ ਇੰਜਰੀ ਹੋ ਜਾਂਦੀ ਹੈ ਉਹਨਾਂ ਨੂੰ ਇਹਨਾਂ ਸਾਰੀਆਂ ਚੀਜ਼ਾਂ ਦਾ ਵੀ ਜਿਹੜਾ ਮਤਲਬ ਕਾਫੀ ਧਿਆਨ ਰੱਖਣਾ ਪੈਂਦਾ ਕੁਛ ਉਹਦੇ 'ਚ ਮੂਵਮੈਂਟ ਕਾਫੀ ਤੇਜ਼ ਹੁੰਦੇ ਨੇ ਜਿਹਦੇ ਨਾਲ ਉਹਨਾਂ ਦੇ ਜਿਹੜੇ ਬੋਡੀ ਹੈਗੀ ਆ ਉਹਨਾਂ 'ਚ ਵੀ ਖਿਚਾਉ ਜਿਹੜਾ ਪੈ ਜਾਂਦਾ ਜਿਹਨੂੰ ਕਾਫੀ ਦੇਰ ਲੱਗ ਜਾਂਦੀ ਹੈ ਨਿਕਲਣ 'ਚ ਅਤੇ ਜਿਹੜੇ ਸਟਾਰਟਰਸ ਹੈਗੇ ਨੇ ਉਹਨਾਂ ਦੀ ਤਾਂ ਵੈਸੇ ਹੀ ਬੋਡੀ ਜਿਹੜੀ ਉਹ ਕਾਫੀ ਸਵੇਰ ਜਿਹੜੀ ਹੈ ਉਹ ਮਤਲਬ ਪੇਨ ਜਿਹੜੀ ਹੈ ਉਹ ਹੋਣੀ ਜਾਂਦ ਹੋਣੀ ਜਿਹੜੀ ਉਹ ਸ਼ੁਰੂ ਹੋ ਜਾਂਦੀ ਹੈ ਅਤੇ ਜੇ ਉਹ ਡਾਂਸਿੰਗ ਦੇ ਕਰੀਅਰ ਵਿੱਚ ਨਹੀਂ ਅੱਗੇ ਵੱਧਦੇ ਹੈ ਨਾ ਕਿ ਵੀ ਜੇ ਉਹ ਕਾਫੀ ਦੇਰ ਤੋਂ ਡਾਂਸਿੰਗ ਦੇ ਕਰੀਅਰ 'ਚ ਨੇ ਲੇਕਿਨ ਉਹ ਨਹੀਂ ਉਸ 'ਚ ਗਰੋਅ ਕਰ ਪਾਉਂਦੇ ਅਤੇ ਫਿਰ ਉਹਨਾਂ ਨੂੰ ਮਤਲਬ ਖੁਦ ਨੂੰ ਵੀ ਬਹੁਤ ਮੈਂਟਲ ਸਟਰੈਸ ਹੋ ਜਾਂਦਾ ਕਿਉਂਕਿ ਉਹ ਕਾਫੀ ਡਿਵੋਸ਼ਨ ਨਾਲ ਉਸ ਚੀਜ਼ ਵੱਲ ਅੱਧ ਅੱਗੇ ਵੱਧਦੇ ਨੇ ਅਤੇ ਉਹਨਾਂ ਨੂੰ ਕਾਫੀਆਂ ਪ੍ਰੋਬਲਮਸ ਆਉਂਦੀਆਂ ਅਤੇ ਫਿਰ ਵੀ ਉਹ ਉਸ ਕਰੀਅਰ ਨੂੰ ਅੱਗੇ ਮਤਲਬ ਪ੍ਰੋਸੀਡ ਨਹੀਂ ਕਰ ਪਾਉਂਦੇ ਅਤੇ ਉਹਨਾਂ ਨੂੰ ਮੈਂਟਲ ਸਟਰੈਸ ਵੀ ਜਿਹਦੇ ਨਾਲ ਹੋ ਜਾਂਦਾ ਵੈ